ਜੀ ਜੀ ਸਤਿ ਸ਼੍ਰੀ ਅਕਾਲ ਜੀ ਬਿਲਕੁਲ ਉਨ੍ਹਾਂ ਦਾ ਮੈਨੇਜਰ ਬੋਲਦਾ ਪਿਆ ਜੀ ਮਨਜੀਤ ਸਿੰਘ ਜੀ ਜੀ ਹਾਂਜੀ ਬਿਲਕੁਲ ਤੁਸੀਂ ਕਿੱਥੇ ਜਾਣਾ ਚਾਹੁੰਦੇ ਹੋ ਜੀ ਜੀ ਬਿਲਕੁਲ ਅਵੇਲੇਵਲ ਹੈ ਜੀ ਹਰ ਤਰ੍ਹਾਂ ਦਾ ਇੱਥੇ ਜਿਵੇਂ ਕਿ ਤੁਸੀਂ ਅੰਮ੍ਰਿਤਸਰ ਦੇ ਸਾਰੇ ਗੁਰਦੁਆਰੇ ਵੇਖ ਸਕਦੇ ਜੇ ਤਰਨ ਤਾਰਨ ਜੋ ਵੀ ਹਿਸਟੋਰੀਕਲ ਪਲੇਸ ਆ ਵਾਹਗਾ ਬੋਡਰ 'ਤੇ ਜਾਣਾ ਵਾ ਹਰੇਕ ਸਿਟੀ ਦੇ ਵਿੱਚ ਸਾਡੀ ਬੱਸ ਜਾਂਦੀ ਆ ਜਿਵੇਂ ਕਿ ਮਖੂ ਜੀਰਾ ਲੁਧਿਆਣਾ ਚੰਡੀਗੜ੍ਹ ਪੰਜਾਬ ਦੇ ਹਰ ਕੋਨੇ 'ਤੇ ਹੋਰ ਇੱਥੇ ਹਰੀ ਕੇ ਗੁਰਦੁਆਰਾ ਸਾਹਿਬ ਹੈਗਾ ਵਾ ਇੱਧਰ ਵੀ ਆਪਣੀਆਂ ਬੱਸਾਂ ਜਿਹੜੀਆਂ ਵਾ ਜਾਂਦੀਆਂ ਵਾ ਜਲੰਧਰ ਅੰਮ੍ਰਿਤਸਰ ਤਰਨ ਤਾਰਨ ਦੇ ਅ ਗੁਰਦੁਆਰਾ ਸਾਹਿਬ ਹੈਗਾ ਗੋਲਡਨ ਟੈਂਪਲ ਹੈਗਾ ਅੰਮ੍ਰਿਤਸਰ ਤਰਨ ਤਾਰਨ ਗੁਰਦੁਆਰਾ ਸਾਹਿਬ ਹੈਗਾ ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਹਾਂ ਔਰ ਤੁਸੀਂ ਵੈਸੇ ਕਿੰਨੇ ਚਿਰ ਦਾ ਟੂਰ ਆ ਅਤੇ ਵਾਪਸ ਕਦੋਂ ਜਾਣਾ ਜੀ ਅੱਛਾ ਜੀ ਵਾਪਸੀ ਸਾਡੀ ਬਸ ਤਾਂ ਸ਼ਾਮ ਨੂੰ ਚਾਰ ਵਜੇ ਦਿੱਲੀ ਲਈ ਚੱਲਦੀ ਆ ਤਾਂ ਦੂਸਰੀ ਬੱਸ ਅ ਰਾਤੀਂ ਸਾਢੇ ਅੱਠ ਵਜੇ ਨੌਂ ਵਜੇ ਜਿਹੜੀ ਆ ਜੋ ਕਿ ਸਵੇਰੇ ਤੁਹਾਨੂੰ ਜਿਹੜੀ ਨੌਂ ਵਜੇ ਚੱਲਦੀ ਆ ਕੋਈ ਪੰਜ ਸਾਢੇ ਪੰਜ ਵਜੇ ਦਿੱਲੀ ਪਹੁੰਚਾ ਦੇਵੇਗੀ ਠੀਕ ਹੈ ਜੀ ਮਿਹਰਬਾਨੀ ਜੀ ਆਇਆਂ ਨੂੰ ਵੈਲਕਮ